ਪੰਜਾਬ ਦੇ ਲੋਕ ਆਪਣੀ ਰਚਨਾਤਮਕ ਅਤੇ ਕਲਾਤਮਕ ਪ੍ਰਤਿਭਾ ਨੂੰ ਸਮੇਂ ਸਮੇਂ 'ਤੇ ਕਈ ਤਰੀਕਿਆਂ ਨਾਲ ਉਜਾਗਰ ਕਰਦੇ ਰਹਿੰਦੇ ਹਨ ਕਈ ਲੋਕਾਂ ਤੋਂ ਆਪਣੇ ਇਸ ਹੁਨਰ ਨੂੰ ਜ਼ਿੰਦਗੀ ਵਿੱਚ ਕਿੱਤੇ ਦੇ ਤੌਰ 'ਤੇ ਅਪਣਾਇਆ ਹੈ ਆਪਣੇ ਹੁਨਰ ਵਿੱਚ ਮੁਹਾਰਤ ਰੱਖਣ ਵਾਲੇ ਲੋਕਾਂ ਵਿੱਚ ਤਰਖਾਣ ਲੁਹਾਰ ਘੁਮਿਆਰ ਸੁਨਿਆਰ ਠਠਿਆਰ ਮੋਚੀ ਜੁਲਾਹੇ ਆਦਿ ਕ ਲੋਕ ਸ਼ਾਮਿਲ ਹਨ ਇਹਨਾਂ ਧੰਦਿਆਂ ਨਾਲ ਵਿਸ਼ੇਸ਼ ਪ੍ਰਕਾਰ ਦੀ ਸਿਆਣਪ ਕੁਸ਼ਲਤਾ ਅਤੇ ਕਾਰੀਗਰੀ ਜੁੜੀ ਹੋਈ ਹੈ ਤਰਖਾਣ ਲੱਕੜੀ ਦਾ ਧੰਦਾ ਕਰਦਾ ਹੈ ਉਹ ਮੰਜੇ ਪੀੜੀਆਂ ਨਿੱਤ ਵਰਤੋਂ ਦੀਆਂ ਹੋਰ ਚੀਜ਼ਾਂ ਦੀ ਮੁਰੰਮਤ ਕਰਨ ਦੇ ਨਾਲ ਨਾਲ ਖੇਤੀਬਾੜੀ ਸੰਬੰਧੀ ਔਜ਼ਾਰ ਜਿਵੇਂ ਕਿ ਰੰਬੇ ਦਾਤੀਆਂ ਆਦਿ ਤਿਆਰ ਕਰਦਾ ਹੈ ਘੁਮਿਆਰ ਦਾ ਕੰਮ ਮਿੱਟੀ ਦੇ ਭਾਂਡੇ ਦੀਵੇ ਹੋਰ ਘਰੇਲੂ ਵਸਤੂਆਂ ਬਣਾਉਣਾ ਹੁੰਦਾ ਹੈ ਮੋਚੀ ਦਾ ਕੰਮ ਚਮੜੇ ਦੀਆਂ ਜੁੱਤੀਆਂ ਤਿਆਰ ਕਰਨਾ ਅਤੇ ਠਠਿਆਰ ਪਿੱਤਲ ਕੈਂਹ ਅਤੇ ਤਾਂਬੇ ਦੇ ਬਰਤਨ ਬਣਾਉਂਦਾ ਹੈ ਇਹਨਾਂ ਤੋਂ ਇਲਾਵਾ ਬਾਂਸਾਂ ਤੋਂ ਤਰ੍ਹਾਂ ਤਰ੍ਹਾਂ ਦੇ ਘਰੇਲੂ ਅਤੇ ਸਜਾਵਟ ਦੇ ਸਮਾਨ ਤਿਆਰ ਕੀਤੇ ਜਾਂਦੇ ਹਨ ਜਿਵੇਂ ਕਿ ਡਿਜ਼ਾਇਨਦਾਰ ਟੋਕਰੀਆਂ ਪੱਖੀਆਂ ਕੁਰਸੀਆਂ ਮੇਜ ਆਦਿ ਫੁੱਲਦਾਨ ਵੀ ਬਣਾਏ ਜਾਂਦੇ ਹਨ ਇਸ ਤਰ੍ਹਾਂ ਆਪਣੀ ਰਚ ਕਲਾਤਮਿਕ ਪ੍ਰਤਿਭਾ ਦਾ ਬੁਣਾਈ ਕੁਤਾਈ ਵਿੱਚ ਵੀ ਆਪਣਾ ਹੁਨਰ ਨ ਝਲਕਦਾ ਹੈ ਜਿਵੇਂ ਕਿ ਦਰੀਆਂ ਚਾਦਰਾਂ ਖੇਸਾਂ ਨੂੰ ਘਰ ਵਿੱਚ ਤਿਆਰ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਰੂੰ ਨੂੰ ਪਿੰਜਾ ਕੇ ਉਹਨੂੰ ਕੱਤਿਆ ਜਾਂਦਾ ਹੈ ਉਸ ਤੋਂ ਬਾਅਦ ਉਹਦੀਆਂ ਦਰੀਆਂ ਡਿਜ਼ਾਇਨ ਪਾ ਪਾ ਕੇ ਮੋਰ ਤੋਤੇ ਘੁੱਗੀਆਂ ਆਦਿ ਨਾਲ ਸਜਾ ਕੇ ਤਿਆਰ ਕੀਤੀਆਂ ਜਾਂਦੀਆਂ ਹਨ ਖੇਸ ਵੀ ਘਰਾਂ ਵਿੱਚ ਬਣਾਏ ਜਾਂਦੇ ਹਨ ਅਤੇ ਚਾਦਰਾਂ ਨੂੰ ਵੀ ਘਰਾਂ ਵਿੱਚ ਹੀ ਬਣਾ ਤਿਆਰ ਕੀਤਾ ਜਾਂਦਾ ਹੈ ਇਸ ਤਰ੍ਹਾਂ ਖੂਬਸੂਰਤ ਡਿਜਾਇਨਾਂ ਨਾਲ ਸ਼ਿੰਗਾਰ ਕੇ ਅਤੇ ਰੰਗ ਬਿਰੰਗੇ ਕੱਪੜੇ ਤਿਆਰ ਕੀਤੇ ਜਾਂਦੇ ਹਨ ਇਸ ਲੋਕਾਂ ਦੀ ਰਚਨਾਤਮਕ ਪ੍ਰਤਿਭਾ ਜਿਹੜੀ ਹੈ ਉਹ ਬਹੁਤ ਉਭਰ ਕੇ ਨਜ਼ਰ ਆਉਂਦੀ ਹੈ ਅਜੋਕੇ ਕੰਪਿਊਟਰ ਦੇ ਵਕਤ ਵਿੱਚ ਲੋਕ ਆਪਣੀ ਪ੍ਰਤਿਭਾ ਦਾ ਖੂ ਬਾਖੂਬੀ ਇਸਤੇਮਾਲ ਕਰ ਰਹੇ ਹਨ ਆਪਣੀ ਪ੍ਰਤਿਭਾ ਨੂੰ ਉਹ ਤਰ੍ਹਾਂ ਤਰ੍ਹਾਂ ਦੀਆਂ ਐਗਜ਼ੀਬੀਸ਼ਨਾਂ ਲਗਾ ਕੇ ਸ਼ੋ ਕਰਦੇ ਰਹਿੰਦੇ ਹਨ ਇਨ੍ਹਾਂ ਐਗਜੀਬੀਸ਼ਨਾਂ ਵਿੱਚ ਤਿਆਰ ਕੀਤੇ ਸਮਾਨ ਨੂੰ ਦਿਖਾਇਆ ਜਾਂਦਾ ਹੈ ਅਤੇ ਲੋਕ ਆਪਣੀ ਲੋੜ ਅਨੁਸਾਰ ਇਹਨਾਂ ਤੋਂ ਆਪਣੇ ਚੀਜ਼ਾਂ ਖਰੀਦਦੇ ਹਨ ਅਤੇ ਘਰਦਾ ਸ਼ਿੰਗਾਰ ਬਣਾਉਂਦੇ ਹਨ